ਮੇਰਾ ਮਨਪਸੰਦ ਲੇਖਕ ਐੱਸ ਸੀ ਤ੍ਰਿਪਾਠੀ ਹਨ ਜਿਹੜੇ ਕਿ ਬਾਇਲੋਜੀ ਦੇ ਉੱਪਰ ਆਪਣੀਆਂ ਕਿਤਾਬਾਂ ਲਿਖਦੇ ਹਨ ਉਹ ਕਿਤਾਬਾਂ ਜਿਹੜੀਆਂ ਨੇ ਉਹ ਬਾਇਲੋਜੀ ਦੇ ਬੱਚਿਆਂ ਦੇ ਲਈ ਜਿਹੜੇ ਬੱਚੇ ਬਾਇਲੋਜੀ ਪੜ੍ਹਦੇ ਨੇ ਜਾਂ ਅਸੀਂ ਕਹਿ ਦੇਈਏ ਜੀਵ ਵਿਗਿਆਨ ਪੜ੍ਹਦੇ ਨੇ ਉਹਨਾਂ ਲਈ ਬਹੁਤ ਹੀ ਲਾਭਦਾਇਕ ਨੇ ਮੈਂ ਇੱਕ ਆਪ ਜੀਵ ਵਿਗਿਆਨ ਪੜ੍ਹਾਉਣ ਵਾਲੀ ਅਧਿਆਪਕਾ ਵਾਂ ਅਤੇ ਉਹਨਾਂ ਦੀਆਂ ਕਿਤਾਬਾਂ ਦੇ ਨਾਲ ਹੀ ਮੈਂ ਆਪਣੇ ਕਲਾਸ ਵਿੱਚ ਆਪਣੇ ਵਿਦਿਆਰਥੀਆਂ ਨੂੰ ਸਮਝਾਉਂਦੀ ਹਾਂ ਉਹਨਾਂ ਦੀਆਂ ਕਿਤਾਬਾਂ ਹਰ ਇੱਕ ਕਲਾਸ ਦੇ ਅਨਰੂਪ ਵਧੀਆ ਨੇ ਸਿਰਫ ਇਹੀ ਨਹੀਂ ਉਹਨਾਂ ਨੇ ਇਕੱਲੀਆਂ ਕ ਕਲ ਕਲਾਸਾਂ ਨੂੰ ਧਿਆਨ ਰੱਖ ਕੇ ਨਹੀਂ ਕਿਤਾਬਾਂ ਲਿਖੀਆਂ ਕੁਛ ਕਿਤਾਬਾਂ ਉਹਨਾਂ ਦੀਆਂ ਆਮ ਜੀਵਨ ਦੇ ਨਾਲ ਵੀ ਮਿਲਦੀਆਂ ਨੇ ਜਿਹਦੇ ਵਿੱਚ ਉਹਨਾਂ ਨੇ ਜੀਵ ਵਿਗਿਆਨ ਨੂੰ ਬੜਾ ਹੀ ਉਤਸ਼ਾਹਿਤ ਕੀਤਾ ਹੈ ਇਹ ਚੀਜ਼ ਪੜ੍ਹ ਕੇ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ ਕਿ ਆਪਣੇ ਹੀ ਸਬਜੈਕਟ ਦੇ ਵਿੱਚ ਆਪਣਾ ਹੀ ਜਿਹੜਾ ਸਾਡਾ ਵਿਸ਼ਾ ਹੈ ਉਹਦੇ ਬਾਰੇ ਜਦੋਂ ਤੁਹਾਨੂੰ ਕੋਈ ਇੱਕ ਚੰਗੀ ਕਿਤਾਬ ਮਿਲੇ ਉਹਨੂੰ ਪੜ੍ਹ ਕੇ ਬਹੁਤ ਮਨ ਖੁਸ਼ ਹੁੰਦਾ ਹੈ ਅਤੇ ਸਿੱਖਣ ਨੂੰ ਬਹੁਤ ਕੁਛ ਮਿਲਦਾ ਹੈ